ਹੈਲੋ ਹਾਂ ਮੰਤਰੀ ਪੁੱਤ ਕੀ ਹਾਲ ਨੇ ਸਭ ਵਧੀਆ ਘਰਦੇ ਸਭ ਠੀਕ ਠਾਕ ਸਭ ਵਧੀਆ ਸਭ ਵਧੀਆ ਹਾਂ ਮੈਂ ਵੀ ਸੋਚ ਰਿਹਾ ਇੱਕ ਸਟਾਰਟਅਪ ਸ਼ੁਰੂ ਕਰਨ ਦਾ ਮੰਤਰੀ ਪਰ ਮੈਂ ਨਾ ਸੋਚਣ ਰਿਹਾ ਸੀ ਆਪਾਂ ਇੱਕ ਐਪ ਬਣਾਉਂਦੇ ਹਾਂ ਹਾਂ ਐਪ ਦਾ ਮੈਂ ਆਹ ਸੋਚਿਆ ਜਿਵੇਂ ਕਿ ਲੋਕਾਂ ਨੂੰ ਸੱਪ ਕੱਟ ਲੈਂਦੇ ਆ ਅਤੇ ਉਹ ਸੱਪ ਪਤਾ ਨਹੀਂ ਲੱਗ ਪਾਉਂਦਾ ਕਿਹੜਾ ਹੈਗਾ ਆ ਹਾਂ ਜ਼ਿਆਦਾਤਰ ਲੋਕਾਂ ਨੂੰ ਪ੍ਰੋਬਲਮ ਆਉਂਦੀ ਆ ਹੈ ਨਾ ਅਤੇ ਫਿਰ ਉਹਦੇ ਕਰਕੇ ਲੋਕਾਂ ਨੂੰ ਫਸਟ ਏਡ ਨਹੀਂ ਮਿਲ ਪਾਉਂਦੀ ਆ ਸਮੇਂ ਠੀਕ ਸਮੇਂ 'ਤੇ ਅਤੇ ਫਿਰ ਮੈਂ ਐਪ ਸੋਚ ਲਿਆ ਬਣਾਉਣ ਦਾ ਕਿ ਉਹ 'ਚ ਨਾ ਮਸ਼ੀਨ ਲਰਨਿੰਗ ਆਪਾਂ ਇੰਪਲੀਮੈਂਟ ਕਰੀਏ ਕਿਉਂਕਿ ਸਾਨੂੰ ਸਾਡੇ ਕੋਰਸ 'ਤੇ ਵੀ ਮਸ਼ੀਨ ਲਰਨਿੰਗ ਤਾਂ ਸਿਖਾਈ ਗਈ ਹੈ ਅਤੇ ਆਪਾਂ ਉਹ ਜੇ ਇੰਪਲੀਮੈਂਟ ਕਰਕੇ ਇੱਕ ਐਪ ਬਣਾਉਂਦੇ ਹਾਂ ਕਿ ਜਿਹਦੇ ਤੋਂ ਸੱਪ ਦੀ ਫੋਟੋ ਤੋਂ ਵੈਰੀਫਾਈ ਪਤਾ ਲੱਗ ਜੇ ਕਿ ਕਿਹੜਾ ਸੱਪ ਨੇ ਉਹਨੂੰ ਵੱਢਿਆ ਹੈਗਾ ਹਾਂ ਮੈਨੂੰ ਵੀ ਬਹੁਤ ਵਧੀਆ ਲੱਗਿਆ ਮੈਂ ਵੀ ਸ ਸੋਚਿਆ ਕਿ ਤੇਰੇ ਨਾਲ ਸਾਂਝਾ ਕਰੀਏ ਆਹ ਟੋਪਿਕ ਠੀਕ ਹੈ ਮੰਤਰੀ ਪਰ ਓਕੇ